ਪੰਜਾਬ ਵਿੱਚ ਬਹੁਤ ਹੀ ਫਸਲਾਂ ਉਗਾਈਆਂ ਜਾਂਦੀਆਂ ਹਨ ਉਸ ਵਿੱਚ ਕਣਕ ਕਣਕ ਵੀ ਤਿੰਨ ਤੋਂ ਚਾਰ ਮਹੀਨੇ ਵਿੱਚ ਹੀ ਇਹਦੀ ਪੈਦਾਵਾਰ ਹੋ ਜਾਂਦੀ ਹੈ ਜੋ ਕਿ ਅਪ੍ਰੈਲ ਮਹੀਨੇ ਵਾਢੀਆਂ ਤੋਂ ਪਹਿਲਾਂ ਪਹਿਲਾਂ ਹੀ ਇਸ ਨੂੰ ਵਡ ਤੇ ਜਾਂਦਾ ਹਨ ਇਸ ਤੋਂ ਬਾ ਬਾਅਦ ਮੱਕੀ ਬੀਜੀ ਜਾਂਦੀ ਹੈ ਜਿਹਨੂੰ ਸੱਤਰ ਨੱਬੇ ਦਿਨ ਵਿੱਚ ਹੀ ਉਹ ਬੜ ਤੇ ਜਾਂਦਾ ਹਨ ਅਤੇ ਕਪਾਹ ਬੀਜੀ ਜਾਂਦੀ ਹੈ ਕਪਾਹ ਵਿੱਚ ਵੀ ਜਿੱਦਾਂ ਇਹਦੀ ਵਰਤੋਂ ਕ ਰੂ ਕੋਟਨ ਵਾਸਤੇ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਰਜਾਈਆਂ ਗੱਦੇ ਅਤੇ ਸੋਫੇ ਸਰਾਣੇ ਇਹਨਾਂ ਵਿੱਚ ਭਰੀ ਜਾਂਦੀ ਹਨ ਅਤੇ ਪੰਜਾਬ ਵਿੱਚ ਫਸਲਾਂ ਗੰਨਾ ਹੋ ਗਿਆ ਗੰਨੇ ਗੰਨੇ ਦੀ ਵੀ ਬਿਜਾਈ ਕੀਤੀ ਜਾਂਦੀ ਹਨ ਅਤੇ ਝੋਨਾ ਹੋ ਗਿਆ ਝੋਨੇ ਨੂੰ ਧਾਨ ਵੀ ਕਹਿੰਦੇ ਹਨ ਜੋ ਕਿ ਇਹਨਾਂ ਨੂੰ ਝੋਨੇ ਨੂੰ ਵੱਧ ਤੋਂ ਵੱਧ ਪਾਣੀ ਲੱਗਦਾ ਆ ਅਤੇ ਇਸ ਇਸਦੀ ਸਰਕਾਰੀ ਟਿਊਬਵੈਲ ਵਿੱਚ ਪਾਣੀ ਲੱਗਦਾ ਹੈ ਜੋ ਕਿ ਨਹੀਂ ਜੇ ਕਿਉਂਕਿ ਝੋਨਾ ਸਭ ਤੋਂ ਵੱਧ ਪਾਣੀ ਲੈਂਦਾ ਆ

ਡਾਇਰੀ ਆਪਣੀ ਡਾਇਰੀ ਵੀ ਖੋਲ੍ਹ ਸਕਦੇ ਹਾਂ ਫਾਰਮ ਵੀ ਖੋਲ੍ਹ ਸਕਦੇ ਹਾਂ ਅਤੇ ਉਹਨਾਂ 'ਚੋ ਅਸੀਂ ਸਪਲਾਈ ਕਰ ਸਕਦੇ ਹਾਂ ਉਹ ਤੋਂ ਅਸੀਂ ਦੁੱਧ ਮੱਝ ਦੁੱਧ ਦੁੱਧ ਦਹੀਂ ਪਨੀਰ ਮੱਖਣ ਆਦਿ ਕੁਛ ਵੀ ਕਰ ਸਕਦੇ ਹੋ ਨਾ ਕੰਮ ਬਿਜ਼ਨਸ ਵੀ ਕਰ ਸਕਦੇ ਹਾਂ ਜੋ ਕਿ ਪੰਜਾਬ ਵਿੱਚ ਇਹਨਾਂ ਦੀ ਬਹੁਤ ਸਾਰੇ ਲਾ ਲਾਭ ਹੈ